ਸਾਡੇ ਜਲੰਧਰ ਸ਼ਹਿਰ ਵਿੱਚ ਬਹੁਤ ਜ਼ਿਆਦਾ ਆਬਾਦੀ ਵਾਲੇ ਜਗਾਵਾਂ ਹਨ ਜਿੱਦਾਂ ਸਾਦੇ ਬਸਤੀਆਂ ਵਾਲੇ ਪਾਸੇ ਅਤੇ ਭਗਤ ਸਿੰਘ ਚੌਂਕ ਮਹਿਰਾ ਗੇਟ ਅਤੇ ਫਗਵਾੜਾ ਗੇਟ ਅਤੇ ਰੇਲਵੇ ਸਟੇਸ਼ਨ ਅਤੇ ਬਸ ਸਟੈਂਡ ਦੇ ਕੋਲ ਬਹੁਤ ਹੀ ਭੀੜ ਭੜੱਕੇ ਵਾਲੇ ਜਗਾਵਾਂ ਹਨ ਜਿਸ ਤਰ੍ਹਾਂ ਜਲੰਧਰ ਦੀ ਆਬਾਦੀ ਦਿਨੋ ਦਿਨ ਵਧਦੀ ਜਾ ਰਹੀ ਹੈ ਉਸ ਕਰਕੇ ਸਥਾਨ ਵੀ ਵਧਦੇ ਜਾ ਰਹੇ ਹਨ ਅਤੇ ਕਲੋਨੀਆਂ ਵੀ ਵੱਧਦੀ ਜਾ ਰਹੀ ਹਨ ਅਸੀਂ ਮੰਨਦੇ ਹਾਂ ਕਿ ਜੋ ਵੀ ਇਸੇ ਰਹਿਣ ਵਿੱਚ ਸਰਮਾਤਮਕ ਅਤੇ ਨਰਾਤਕ ਪਹਿਲੂ ਬੜੇ ਬਣ ਜਾਂਦੇ ਹਨ ਕਿਉਂਕਿ ਇਸ ਵਸਦੇ ਸ਼ਹਿਰ ਵਿੱਚ ਜ਼ਿਆਦਾ ਤੋਂ ਜ਼ਿਆਦਾ ਲਾਈਟਾਂ ਬਹੁਤ ਕਵਰ ਹੋ ਜਾਂਦੀਆਂ ਜਿਹਦੇ ਕਰਕੇ ਲਾਈਟਾਂ 'ਚ ਬਹੁਤ ਜ਼ਿਆਦਾ ਟਰੈਫਿਕ ਰਹਿੰਦਾ ਹੈ ਇੱਕ ਅੱਛਾ ਸ਼ਹਿਰ ਹੋਣਾ ਵੀ ਵਧੀਆ ਵੀ ਹੁੰਦਾ ਅਤੇ ਉਹਦੇ ਨੁਕਸਾਨ ਵੀ ਹੁੰਦੇ ਹਨ ਜਿੰਨਾਂ ਸ਼ਹਿਰ ਵੱਡਾ ਉੰਨੀ ਉਹਦੀ ਚੌਂਕ ਅਤੇ ਲਾਈਟਾਂ ਟਰੈਫਿਕ ਕਾਰਾਂ ਅਤੇ ਸਾਰਾ ਕੁਛ ਵੱਧ ਜਾਂਦਾ ਹੈ ਲੇਕਿਨ ਇਹਦੇ ਕਰਕੇ ਸਾਨੂੰ ਆ ਵੀ ਹੈ ਕਿ ਜਿੰਨੇ ਸ਼ਹਿਰ ਦੀ ਡਿਵੈਲਪਮੈਂਟ ਹੁੰਦੀ ਹੈ ਉਹਨਾਂ ਸਾਨੂੰ ਫ਼ਾਇਦਾ ਵੀ ਹੁੰਦਾ ਹੈ ਉੰਨੇ ਸਾਡੇ ਰੋਜ਼ਗਾਰ ਦੇ ਅਤੇ ਹਰ ਤਰ੍ਹਾਂ ਦੇ ਤਰੀਕੇ ਵੀ ਪਹਿਲੂ ਖੁਲ੍ਹਦੇ ਹਨ ਲੇਕਿਨ ਇਸ ਦੇ ਵਿੱਚ ਸ਼ਹਿਰ ਵਿੱਚ ਸਭ ਤੋਂ ਜ਼ਿਆਦਾ ਬਦਲਾਵ ਦੀ ਜ਼ਰੂਰਤ ਹੈ ਉਹ ਹੈ ਟਰੈਫਿਕ ਟਰੈਫਿਕ ਸਾਡੇ ਲਈ ਅੱਜ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਜਿੰਨਾ ਵੱਡਾ ਸ਼ਹਿਰ ਉੰਨਾਂ ਵੱਡਾ ਟ੍ਰੈਫਿਕ